ਕਿਸਾਨ ਆਪਣੇ ਜਾਨਵਰਾਂ ਲਈ ਸਭ ਤੋਂ ਪਹਿਲਾਂ ਸ਼ੈੱਡ ਬਣਾਉਂਦੇ ਹਨ ਉੱਥੇ ਖੁਰਲੀ ਬਣਾਉਂਦੇ ਹਨ ਅਤੇ ਇੱਕ ਸਾਈਡ 'ਤੇ ਬਹੁਤ ਵੱਡਾ ਹੋਲ ਬਣਾਉਂਦੇ ਹਨ ਜਿਹਦੇ ਵਿੱਚ ਉਹ ਜਾਨਵਰਾਂ ਲਈ ਚਾਰਾ ਰੱਖਦੇ ਹਨ ਅਤੇ ਇੱਕ ਸਾਈਡ 'ਤੇ ਉਹ ਆਪਣੇ ਜਾਨਵਰਾਂ ਲਈ ਉਹਨਾਂ ਦਾ ਮਲ ਮੂਤਰ ਇਕੱਠਾ ਕਰਦੇ ਹਨ ਜਿਹੜਾ ਉਹਨਾਂ ਦਾ ਗੋਬਰ ਹੁੰਦਾ ਹੈ ਉਹ ਚੱਕ ਕੇ ਉਹ ਪਾਥੀਆਂ ਵੀ ਬਣਾ ਲੈਂਦੇ ਹਨ ਜਿਹਦੇ ਨਾਲ ਅਸੀਂ ਚੁੱਲ੍ਹਾ ਬਾਲਦੇ ਹਨ ਸਾਡੀ ਗੈਸ ਦੀ ਸਮੱਸਿਆ ਦੂਰ ਹੁੰਦੀ ਹੈ ਔਰ ਕੁਛ ਖਾਦ ਮਤਲਬ ਗੋਬਰ ਜਿਹੜਾ ਹੈਗਾ ਉਹ ਖੇਤਾਂ ਵਿੱਚ ਸੁੱਟਦੇ ਹਨ ਜਿਹਦੇ ਨਾਲ ਖਾਦ ਦੀ ਵਰਤੋਂ ਹੁੰਦੀ ਹੈ ਖਾਦ ਸਾਡੇ ਖੇਤਾਂ ਲਈ ਬਹੁਤ ਜ਼ਰੂਰੀ ਹੈ ਯੂਰੀਆ ਸਾਡੇ ਅੰਨ ਨੂੰ ਨੁਕਸਾਨ ਪਹੁੰਚਾਉਂਦੇ ਹਨ ਜੋ ਗੋਬਰ ਹੈ ਉਹ ਸਾਡਾ ਦੇਸੀ ਖਾਦ ਹੈ ਜਿਹਦੇ ਨਾਲ ਸਾਡੇ ਅਨਾਜ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਔਰ ਸਾਡੇ ਹਾਂਜੀ ਸਾਡੇ ਖੇਤਾਂ ਲਈ ਬਹੁਤ ਵਧੀਆ ਹੈ ਖੇਤ ਨੂੰ ਉਪਜਾਊ ਬਣਾਉਂਦੇ ਹਨ ਧੰਨਵਾਦ